ਹਾਂ ਮੈਂ ਬਾਈਕਿੰਗ ਰੇਸ ਵਿੱਚ ਹਿੱਸਾ ਲਿਆ ਸੀ ਉਸ ਪਰ ਮੇਰਾ ਉਹ ਅਨੁਭਵ ਕੁਛ ਖਾਸ ਵਧੀਆ ਨਹੀਂ ਰਿਹਾ ਸੀ ਜਦੋਂ ਮੈਂ ਇਸ ਰੇਸ ਵਿੱਚ ਹਿੱਸਾ ਲਿਆ ਤਾਂ ਮੈਨੂੰ ਇੱਕ ਵਾਰੀ ਤਾਂ ਬਹੁਤ ਡਰ ਮਹਿਸੂਸ ਹੋ ਰਿਹਾ ਸੀ ਅਤੇ ਦਿਲ ਧੜਕ ਰਿਹਾ ਸੀ ਪਰ ਬਾਅਦ ਵਿੱਚ ਮੈਨੂੰ ਫਿਰ ਵੀ ਕੁਛ ਰਾਹਤ ਮਹਿਸੂਸ ਹੋਈ ਤਾਂ ਮੈਂ ਜਦੋਂ ਰੇਸ ਵਿੱਚ ਹਿੱਸਾ ਲਿਆ ਤਾਂ ਮੈਨੂੰ ਰੇਸ ਬਹੁਤ ਮੁਸ਼ਕਿਲ ਲੱਗਿਆ ਕਿਉਂਕਿ ਰਸਤਾ ਵੀ ਸਾਫ ਨਹੀਂ ਸੀ ਅਤੇ ਕੁਝ ਮੇਰੇ ਦਿਲ ਵਿੱਚ ਇਹ ਭਾਵਨਾ ਸੀ ਕਿ ਮੈਂ ਪਤਾ ਨਹੀਂ ਜਿੱਤੂਗੀ ਕਿ ਨਹੀਂ ਜਿੱਤੂਗੀ ਉਹ ਅਨੁਭਵ ਮੇਰਾ ਠੀਕ ਸੀ ਬਟ ਮੈਂ ਫਿਰ ਫਿਰ ਵੀ ਇਸ ਵਿੱਚ ਬੜੇ ਹੌਸਲੇ ਨਾਲ ਅੱਗੇ ਵੱਧਦੀ ਜਾ ਰਹੀ ਸੀ ਅਤੇ ਅੰਤ ਵਿੱਚ ਮੈਂ ਜਿੱਤ ਗਈ ਸੀ ਪਰ ਜਿੱਤਣ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੇਰੇ ਦਿਲ ਵਿੱਚ ਜੋ ਡਰ ਸੀ ਉਹ ਬਾਅਦ ਵਿੱਚ ਡਰ ਨਿਕਲ ਗਿਆ ਸੀ ਅਤੇ ਜਦੋਂ ਮੈਨੂੰ ਇਨਾਮ ਮਿਲਿਆ ਤਾਂ ਮੈਂ ਬਹੁਤ ਖੁਸ਼ ਸੀ